ਮੈਂ ਸਭ ਤੋਂ ਚੁਣੌਤੀਪੂਰਨ ਟ੍ਰੈਲ ਸਾਈਕਲ 'ਤੇ ਨਹੀਂ ਪਰ ਮੋਟਰਸਾਈਕਲ 'ਤੇ ਨਜਿੱਠਿਆ ਹੈ ਪਿਛਲੇ ਸਾਲ ਮੈਂ ਆਪਣੇ ਦੋਸਤ ਨਾਲ ਲੇਹ ਲਦਾਖ ਗਿਆ ਸੀ ਜਿਸ ਵਿੱਚ ਸਾਡੀ ਮੋਟਰਸਾਈਕਲ ਨੇ ਸਾਨੂੰ ਬਹੁਤ ਤੰਗ ਕੀਤਾ ਉਸ ਦੇ ਟਾਇਰ ਵੀ ਪਾੜ ਗਏ ਅਤੇ ਇੰਜਨ ਵੀ ਸੀਸ ਹੋ ਗਿਆ ਪਰ ਫਿਰ ਵੀ ਅਸੀਂ ਡਰੇ ਨਹੀਂ ਅਸੀਂ ਡੱਟ ਕੇ ਚਲਦੇ ਰਹੇ ਸਾਨੂੰ ਉਸ ਨਾਲ ਬਹੁਤ ਹੀ ਵੱਖਰਾ ਜਿਹਾ ਫੀਲ ਹੋਇਆ ਸਗੋਂ ਸਾਡੇ ਮੋਟਰਸਾਈਕਲ ਨੇ ਸਾਨੂੰ ਬਹੁਤ ਤੰਗ ਕੀਤਾ ਸੁੰਨਸਾਨ ਰਸਤੇ ਵਿੱਚ ਰੁਕ ਗਿਆ ਅਤੇ ਰਾਤ ਦਾ ਸਮਾਂ ਸੀ ਸਾਨੂੰ ਦੋ ਦਿਨ ਤੱਕ ਕੋਈ ਵੀ ਮਦਦ ਨਹੀਂ ਪਹੁੰਚੀ ਅਸੀਂ ਆਪਣੇ ਮੋਟਰਸਾਈਕਲ ਨੂੰ ਧੱਕਾ ਲਿਜਾ ਕੇ ਅੱਗੇ ਵੱਧਦੇ ਰਹੇ ਪਹਾੜੀ ਇਲਾਕਾ ਸੀ ਅਤੇ ਠੰਡ ਵੀ ਬਹੁਤ ਸੀ ਸਾਡੇ ਕੋਲ ਖਾਣ ਪੀਣ ਦਾ ਸਮਾਨ ਵੀ ਲਿਮਿਟਿਡ ਸੀ ਅਸੀਂ ਬਹੁਤ ਘਬਰਾਏ ਹੋਏ ਸਾਂ ਫਿਰ ਤੀਸਰੇ ਜ ਦਿਨ ਜਾ ਕੇ ਸਾਨੂੰ ਮਦਦ ਮਿਲੀ ਅਤੇ ਅਸੀਂ ਉੱਥੇ ਦਸ ਦਿਨ ਰੁਕੇ ਜਦੋਂ ਸਾਡਾ ਮੋਟਰਸਾਈਕਲ ਠੀਕ ਹੋਇਆ ਤਾਂ ਅਸੀਂ ਆਪਣਾ ਅਗਲਾ ਸਫ਼ਰ ਸ਼ੁਰੂ ਕੀਤਾ ਪਰ ਫਿਰ ਵੀ ਅਸੀਂ ਘਬਰਾਏ ਨਹੀਂ ਇਹ ਸਫ਼ਰ ਸਾਡੇ ਲਈ ਬਹੁਤ ਚੁਣੌਤੀਪੂਰਨ ਸੀ ਪਰ ਇਸ ਵਿੱਚ ਫਿਰ ਵੀ ਸਾਨੂੰ ਬਹੁਤ ਮਜ਼ਾ ਆਇਆ ਕਿਉਂਕਿ ਅਸੀਂ ਟੈਨਸ਼ਨ ਫਰੀ ਹੋ ਕੇ ਕੀਤਾ ਸੀ